ਸਤਿ ਸ਼੍ਰੀ ਅਕਾਲ ਜੀ ਮੈਂ ਅਨੂ ਸ਼ਰਮਾ ਬੋਲ ਰਹੀ ਹਾਂ ਹਾਂਜੀ ਕੀ ਮੈਂ ਕਲਸੀ ਟਰ ਟਰਾਵਲਸ ਨਾਲ ਗੱਲ ਕਰ ਸਕਦੀ ਹਾਂ ਹਾਂਜੀ ਸਰ ਮੈਂ ਕੱਲ੍ਹ ਤੁਹਾਡੀ ਕੈਬ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਕੱਲ੍ਹ ਸ਼ਾਮ ਦੀ ਅਸੀਂ ਅੰਮ੍ਰਿਤਸਰ ਜਾਣਾ ਸੀ ਅਤੇ ਅਸੀਂ ਕੈਬ ਤੁਹਾਡੀ ਬੁੱਕ ਕੀਤੀ ਸੀ ਪੰਜ ਵਜੇ ਦੀ ਬਟ ਸਾਡੀ ਕੁਛ ਕਾਰਨ ਕਰਕੇ ਅਸੀਂ ਲੇਟ ਹੋ ਗਏ ਬਟ ਕੈਬ ਵਾਲਾ ਡਰਾਈਵਰ ਜੋ ਵੀ ਸੀ ਉਹ ਉਹਨਾਂ ਨੇ ਸਾਨੂੰ ਸੁਰੱਖਿਅਤ ਮਤਲਬ ਇੱਕ ਘੰਟੇ ਸਾਡੀ ਵੇਟ ਕੀਤੀ ਅਤੇ ਉਹਨਾਂ ਨੇ ਸਾਨੂੰ ਸਾਡੇ ਟਾਈਮ 'ਤੇ ਹੀ ਉਸ ਦੋ ਘੰਟਿਆਂ ਦੇ ਵਿੱਚ ਸਾਨੂੰ ਉਹਨਾਂ ਨੇ ਅੰਮ੍ਰਿਤਸਰ ਪਹੁੰਚਾ ਦਿੱਤਾ ਕਿਉਂਕਿ ਮੈਂ ਅੰਮ੍ਰਿਤਸਰ ਰਾਤ ਦੀ ਫਲਾਈਟ ਫੜਨੀ ਸੀ ਔਰ ਮੈਂ ਘਰੋਂ ਬਹੁਤ ਲੇਟ ਹੋ ਚੁੱਕੀ ਸੀ ਪਰ ਉਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਔਰ ਆਪਣੀ ਡਰਾਈਵਿੰਗ ਕੀਤੀ ਅਤੇ ਮੈਨੂੰ ਬੜੇ ਹੀ ਸੁਰੱਖਿਅਤ ਢੰਗ ਦੇ ਨਾਲ ਮੈਨੂੰ ਅੰਮ੍ਰਿਤਸਰ ਏਅਰਪੋਰਟ ਪਹੁੰਚਾ ਦਿੱਤਾ ਗਿਆ ਮੈਂ ਇਹ ਕੋਲ ਤੁਹਾਡੀ ਧੰਨਵਾਦ ਦੇਣ ਲਈ ਕੀਤੀ ਸੀ ਔਰ ਅੱਗੇ ਤੋਂ ਮੈਂ ਮੈਂ ਇਹ ਸ਼ੁੱਭਕਾਮਨਾ ਚਾਹੁੰਦੀ ਹਾਂ ਕਿ ਮੈਂ ਅੱਗੇ ਤੋਂ ਵੀ ਤੁਹਾਡੀ ਹੀ ਕੈਬ ਇਸਤੇਮਾਲ ਕਰਾਂ ਧੰਨਵਾਦ